ਸਾਡੇ ਭਾਰਤੀ ਸਮਾਜ ਵਿੱਚ ਬਿਜਲੀ ਦੇ ਉਪਕਰਨ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਹਰ ਮਨੁੱਖ ਹਰ ਕੰਮ ਨੂੰ ਕਰਨ ਨੂੰ ਢੰਗ ਸਹੀ ਢੰਗ ਨਾਲ ਕਰਨਾ ਚਾਹੁੰਦਾ ਹੈ ਅਤੇ ਸੁਖਾਲੇ ਤਰੀਕੇ ਨਾਲ ਕਰਨਾ ਚਾਹੁੰਦਾ ਹੈ ਕਿ ਜਿਹਦੇ ਨਾਲ ਉਹ ਹਰ ਕੰਮ ਨੂੰ ਵੱਧ ਤੋਂ ਵੱਧ ਸਮੇਂ ਦੇ ਵਿੱਚ ਖ਼ਤਮ ਕੀਤਾ ਜਾ ਸਕੇ ਇਹਨਾਂ ਦੇ ਵਿੱਚ ਮੌਜੂਦ ਹਨ ਫਰਿੱਜ਼ ਟੀ ਵੀ ਪੱਖਾ ਏ ਸੀ ਕੂਲਰ ਇਹ ਸਭ ਇਸ ਤਰ੍ਹਾਂ ਦੇ ਉਪਕਰਨ ਹਨ ਜਿਹੜਾ ਮਨੁੱਖ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਕਰਦਾ ਹੈ ਇਹਨਾਂ ਦੇ ਬਹੁਤ ਸਾਰੇ ਲਾਭ ਹਨ ਪਰ ਇਹਨਾਂ ਦੇ ਲਾਭ ਹੋਣ ਦੇ ਨਾਲ ਦੇ ਨਾਲ ਕੁਛ ਹਾਨੀਆਂ ਵੀ ਹਨ ਜਿਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਨਹੀਂ ਕਰ ਸਕਦੇ ਜਿਵੇਂ ਕਿ ਇਹਨਾਂ ਦੇ ਇੰਨੇ ਸਾਰੇ ਨੁਕਸਾਨ ਹਨ ਜਿਹਨਾਂ ਦਾ ਮਨੁੱਖ 'ਤੇ ਬਹੁਤ ਹੀ ਗਹਿਰਾ ਪ੍ਰਭਾਵ ਪੈਂਦਾ ਹੈ ਗੱਲ ਕੀਤੀ ਜਾਵੇ ਤਾਂ ਗਰਮੀਆਂ ਦੇ ਵਿੱਚ ਅਸੀਂ ਜਿਹੜੇ ਪੱਖੇ ਏ ਸੀ ਕੂਲਰ ਲਗਾਉਂਦੇ ਹਾਂ ਉਹ ਮਨੁੱਖ ਦੀ ਸਿਹਤ ਨੂੰ ਇੰਨਾ ਕੁ ਪ੍ਰਭਾਵ ਕਰ ਰਹੇ ਹਨ ਕਿ ਮਨੁੱਖ ਵੱਧ ਤੋਂ ਵੱਧ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ ਅਸੀਂ ਫਰਿੱਜ਼ ਦੇ ਵਿੱਚ ਰੱਖਿਆ ਖਾਣੇ ਦੀ ਵਰਤੋਂ ਕਰਦੇ ਹਨ ਉਹਦੇ ਨਾਲ ਵੀ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਿਜਲੀ ਦੇ ਅਜਿਹੇ ਬਹੁਤ ਸਾਰੇ ਖ਼ਤਰੇ ਹਨ ਜਿਵੇਂ ਕਿ ਛੋਟੇ ਬੱਚੇ ਕੁਛ ਨੰਗੀਆਂ ਤਾਰਾਂ ਨੂੰ ਫੜ ਲੈਂਦੇ ਹਨ ਅਤੇ ਉਹਨਾਂ ਦੀ ਜਾਨ ਤੋਂ ਖ਼ਤਰਾ ਜਾਨ ਨੂੰ ਖ਼ਤਰਾ ਰੈਦਾ ਰਹਿੰਦਾ ਹੈ ਅਤੇ ਉਹ ਕਈ ਵਾਰ ਤਾਂ ਇਸ ਤਰ੍ਹਾਂ ਦੀਆਂ ਸਮੱਸਿਆ ਆਉਂਦੀਆਂ ਕਿ ਇਨਸਾਨ ਨੂੰ ਮੌਤ ਦਾ ਸ਼ਿਕਾਰ ਵੀ ਕਰਨਾ ਪੈ ਦਾ ਹੋ ਜਾਂਦਾ ਹੈ ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਅਤੇ ਸਾਨੂੰ ਵੱਧ ਤੋਂ ਵੱਧ ਇਹਨਾਂ ਨੂੰ ਜਿੰਨਾ ਹੋ ਸਕੇ ਸਾਨੂੰ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਹੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਜੇ ਅਸੀਂ ਕੁਛ ਸਾਡਾ ਕੰਮ ਇਸ ਤਰ੍ਹਾਂ ਦਾ ਹੋ ਰਿਹਾ ਹੈ ਕਿ ਅਸੀਂ ਬਿਜਲੀ ਤੋਂ ਬਚਾ ਕਰ ਸਕਦੇ ਹਾਂ ਤਾਂ ਸਾਨੂੰ ਬਚਾਅ ਕਰਨਾ ਚਾਹੀਦਾ ਸਾਨੂੰ ਬੱਚਿਆਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਜਿੱਥੇ ਸਾਨੂੰ ਕਿਤੇ ਲੱਗਦਾ ਹੈ ਕੀ ਤਾਰਾ ਨੰਗੀਆਂ ਹਨ ਅ ਸਾਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਢੱਕਣਾ ਚਾਹੀਦਾ ਹੈ ਅਤੇ ਬਿਜਲੀ ਦੀ ਉੱਨੀ ਕੁ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹਦੇ ਨਾਲ ਸਾਨੂੰ ਬਿਜਲੀ ਦਾ ਕੋਈ ਖ਼ਤਰਾ ਨਾ ਰਹੇ ਵਰਤੋਂ ਹਰ ਉਪਕਰਨ ਦੀ ਕੀਤੀ ਜਾਣੀ ਚਾਹੀਦੀ ਹੈ ਪਰ ਉਹਨੂੰ ਜੇ ਸਹੀ ਢੰਗ ਨਾਲ ਅਤੇ ਸਹੀ ਤਰੀਕੇ ਨਾਲ ਕੀਤਾ ਜਾਵੇ ਤਾਂ ਉਹ ਸਾਡੇ ਵਾਸਤੇ ਲਾਹੇਵੰਦ ਹਨ ਨਹੀਂ ਤਾਂ ਉਹ ਸਾਡੇ ਵਾਸਤੇ ਨੁਕਸਾਨਦੇਹ ਸਾਬਿਤ ਹੋ ਸਕਦੀਆਂ ਹਨ